ਹਾਂਜੀ ਮੈਮ ਤੁਸੀਂ ਕੁਝ ਪੁੱਛਣਾ ਜੀ ਮੈਮ ਮੈਂ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਦੇਖ ਸਕਦੇ ਹੋ ਉਥੇ ਸਾਰਾ ਕੁਝ ਅਵੇਲੇਬਲ ਆ ਚਾਰਜ ਤਾਂ ਮੈਂ ਇਹਨਾਂ ਦਾ ਕੋਈ ਖਾਸ ਚਾਰਜ ਨਹੀਂ ਹੁੰਦਾ ਸਾਡਾ ਠੀਕ ਠਾਕ ਹੀ ਚਾਰਜ ਲੈਦੇ ਆ ਅਸੀਂ ਤੁਸੀਂ ਸਾਡੇ ਲਵੇ ਆਫਿਸ 'ਚ ਵਿਜਿਟ ਕਰ ਸਕਦੇ ਹੋ ਤੇ ਤੁਸੀਂ ਮੈਨੂੰ ਦੱਸ ਦਵਾਂਗੇ ਹਾਂਜੀ ਇਹ ਮੈਮ ਇਹਦਾ ਪ੍ਰੌਸੇਸ ਤਿੰਨ ਚਾਰ ਮਹੀਨਿਆਂ ਦਾ ਹੁੰਦਾ ਤਿਨ ਚਾਰ ਮਹੀਨਿਆਂ ਦੇ ਵਿੱਚ ਵਿੱਚ ਬਣ ਕੇ ਤੁਹਾਡਾ ਪਾਸਵਰਡ ਤੁਹਾਡੇ ਕੋਲ ਆ ਇਹ ਤਾ ਮੈਮ ਤੁਹਾਨੂੰ ਆਫਿਸ 'ਤੇ ਵਿਜਿਟ ਕਰਕੇ ਪਤਾ ਲੱਗੂਗਾ

ਹਾਂਜੀ ਮੈਮ ਤੁਹਾਡਾ ਕੋਈ ਵੀ ਮਤਲਬ ਬੈਂਕ ਸਟੇਟਮੈਂਟ ਲੱਗਦੀ ਹੁੰਦੀ ਹੈ ਨਾਲ ਵੀ ਮਤਲਬ ਕਿ ਕੋਈ ਵੀ ਲੋਨ ਤੁਹਾਡਾ ਨਹੀਂ ਹੋਣਾ ਚਾਹੀਦਾ ਤੇ ਨਾਲ ਇਹਦੇ ਪੁਲਿਸ ਇਨਕ਼ੁਆਇਰੀ ਲੱਗਦੀ ਹੁੰਦੀ ਹੈ ਹਾਂਜੀ ਵੀ ਤੁਹਾਡਾ ਉਹਦੇ ਵਿੱਚ ਕੋਈ ਵੀ ਕੇਸ ਨਹੀਂ ਆਉਣਾ ਚਾਹੀਦਾ ਤੁਹਾਡਾ ਹਾਂਜੀ ਮੈਮ ਹਾਂਜੀ ਇਹੀ ਹੁੰਦਾ ਐਡਰੈਸ ਮੈ ਤੁਹਾਡੀ ਮੈਂ ਈਮੇਲ ਤੇ ਸੈਂਡ ਕਰ ਦਵਾਂਗਾ ਤੁਸੀਂ ਮੈਨੂੰ ਈਮੇਲ ਸੈਂਡ ਕਰ ਦੋ